ਸਿੱਖਿਅਤ ਵਿਅਕਤੀ ਚੰਗੇ ਵਿਵਹਾਰ ਅਤੇ ਸਿਧਾਂਤਾਂ ਦੀ ਪਾਲਣਾ ਕਰਦਾ ਹੈ ਕਿਉਂਕਿ ਜੋ ਸਿੱਖਿਅਤ ਵਿਅਕਤੀ ਹੁੰਦਾ ਹੈ ਉਹ ਅਨਪੜ੍ਹ ਵਿਅਕਤੀ ਤੋਂ ਦੋ ਗੁਣਾ ਜ਼ਿਆਦਾ ਸਮਝਦਾਰ ਹੁੰਦਾ ਹੈ ਜੇ ਜੋ ਆਪਾਂ ਜੇਕਰ ਆਪਾਂ ਅਨਪੜ੍ਹ ਵਿਅਕਤੀ ਨੂੰ ਕੋਈ ਗੱਲ ਸਮਝਾਊਗੇ ਤਾਂ ਉਹ ਥੋੜ੍ਹਾ ਟਾਈਮ ਲੈਂਦਾ ਬਟ ਜੋ ਸਿੱਖਿਅਤ ਵਿਅਕਤੀ ਹੁੰਦਾ ਹੈ ਉਹ ਜਲਦੀ ਕੈਚ ਕਰ ਲੈਂਦੇ ਨੇ ਅਤੇ ਉਹਨਾਂ ਨੂੰ ਆਪਣਾ ਕੰਮ ਸੈਲਫ਼ ਡਿੰਪੈ ਸੈਲਫ ਡਿਪੈਡੈਂਟ ਹੁੰਦੇ ਹੈ ਮਤਲਬ ਆਪਣਾ ਕੰਮ ਖ਼ੁਦ ਕਰ ਸਕਦੇ ਨੇ ਬਟ ਜਿਹੜਾ ਅਨਪੜ੍ਹ ਵਿਅਕਤੀ ਹੈ ਉਹਨੂੰ ਦੂਜੇ ਵਿਅਕਤੀ ਦੀ ਜ਼ਰੂਰਤ ਪਵੇਗੀ ਉਹਦੇ ਹਿਸ ਸਹਾਇ ਹੈਲਪ ਲੈਣੀ ਪੈਂਦੀ ਹੈ ਅਤੇ ਸਿੱਖਿਅਤ ਵਿਅਕਤੀ ਜਿਹੜਾ ਹੁੰਦਾ ਹੈ ਉਹ ਸ ਵੈਲ ਡਿਸੀਪਲੇਨ ਵੈਲ ਮੈਨਰਡ ਆਪਣੀ ਲਾਈਫ਼ ਨੂੰ ਕਿਵੇਂ ਜੀਣਾ ਹੈ ਰੂਲਜ਼ ਐਂਡ ਰੈਗੂਲੇਸ਼ਨ ਨਾਲ਼ ਉਹਨੂੰ ਸਭ ਪਤਾ ਹੁੰਦਾ ਹੈ ਬਟ ਜੋ ਅਨਪੜ੍ਹ ਵਿਅਕਤੀ ਹੁੰਦੇ ਹੈ ਉਹਨਾਂ ਨੂੰ ਆਪਾਂ ਅਗਰ ਕੁਛ ਸਮਝਾਉਣ ਵੀ ਬੈਠਣਗੇ ਕੁਛ ਅਗਰ ਚੇਂਜ ਵੀ ਲਿਆਉਣਾ ਹੋਵੇ ਸੁਸਾਇਟੀ 'ਚ ਹੀ ਲਗਾ ਲਉ ਚਾਹੇ ਉਹ ਬਟ ਆਪਣੀ ਸੋਚ ਹੁੰਦੀ ਹੈ ਜਿਹੜੀ ਉਹਦੇ 'ਤੇ ਅਟਲ ਹੀ ਰਹਿੰਦੇ ਨੇ